ਹਾਂਜੀ ਸਾਡੇ ਕੁਛ ਕੁ ਟਾਈਮ ਪਹਿਲਾਂ ਇੱਥੇ ਇੱਕ ਕੋਲਜ ਆ ਉੱਥੇ ਇੰਟਰਪਨਿਓਰ ਦਾ ਇੱਕ ਪੰਦਰ੍ਹਾਂ ਕੁ ਦਿਨ ਦੀ ਟ੍ਰੇਨਿੰਗ ਜਿਹੀ ਖੁੱਲ੍ਹੀ ਸੀ ਉਹਦੇ ਵਿੱਚ ਬੱਚਿਆਂ ਨੂੰ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਸਟੱਡੀ ਲਾਉਣ ਬਾਰੇ ਦੱਸਿਆ ਜਾ ਰਿਹਾ ਸੀ ਵੀ ਕਿਵੇਂ ਤੁਸੀਂ ਆਪਣੀ ਆਪ ਮਦਦ ਕਰ ਸਕਦੇ ਹੋ ਵੀ ਪੇਰੈਂਟਸ 'ਤੇ ਬਰਡਨ ਨਾ ਪਾਓ ਵੀ ਆਪਣੇ ਆਪ ਆਪਣੇ ਤੁਸੀਂ ਸਟੱਡੀ ਕਰ ਸਕਦੇ ਹੋ ਉਸ ਵਿੱਚ ਇੰਟਰਪਨਿਓਰ ਦਾ ਪੰਦਰ੍ਹਾਂ ਕੁ ਦਿਨ ਦਾ ਕੋਰਸ ਪੂਰਾ ਕਰਨਾ ਹੁੰਦਾ ਸੀ ਲਗਾਤਾਰ ਕਲਾਸਾਂ ਲਗਾ ਕੇ ਇੱਕ ਆਪਾਂ ਨੂੰ ਸਰਟੀਫਿਕੇਟ ਪ੍ਰੋਵਾਈਡ ਕਰਦੇ ਸੀ ਜੋ ਕਿ ਗੌਰਮੈਂਟ ਵੱਲੋਂ ਮਿਲਿਆ ਹੋਇਆ ਸੀ ਜਦੋਂ ਉਹ ਸਰਟੀਫਿਕੇਟ ਆਪਾਂ ਨੂੰ ਮਿਲ ਜਾਂਦਾ ਸੀ ਉਹਦੇ 'ਤੇ ਆਪਾਂ ਨੂੰ ਮਤਲਬ ਕਿ ਸਟੱਡੀ ਲੋਨ ਜਾਂ ਬਿਜ਼ਨਸ ਲੋਨ ਮਿਲਦਾ ਹੁੰਦਾ ਸੀ ਵੀ ਆਪਾਂ ਉਸ ਸਰਟੀਫਿਕੇਟ ਦੇ ਅਧਾਰ 'ਤੇ ਹੀ ਆਪਣੀ ਉੱਥੇ ਜਾਣਾ ਆਫਿਸ ਵਿੱਚ ਅਫਿਸ ਆਫਿਸ ਵਿੱਚ ਜਾ ਕੇ ਉਹ ਸਰਟੀਫਿਕੇਟ ਦਿਖਾਉਣਾ ਉਹਦੇ ਆਧਾਰ 'ਤੇ ਆਪਾਂ ਨੂੰ ਮਤਲਵ ਇੱਕ ਲੋਨ ਮਿਲਦਾ ਹੁੰਦਾ ਸੀ ਜੋ ਕਿ ਆਪਾਂ ਹੌਲੀ ਹੌਲੀ ਕਿਸ਼ਤ ਜਿਵੇਂ ਹਜ਼ਾਰ ਦੋ ਹਜ਼ਾਰ ਪੰਜ ਸੌ ਸੱਤ ਸੌ ਇੱਦਾਂ ਕੁਛ ਕਿਸ਼ਤ ਭਰਨੀ ਹੁੰਦੀ ਸੀ ਉਹ ਕਿਸ਼ਤ ਅਸਾਨੀ ਨਾਲ ਭਰੀ ਜਾਂਦੀ ਹੁੰਦੀ ਸੀ ਤਾਂ ਬੱਚਾ ਆਪਣੀ ਆਸਾਨੀ ਨਾਲ ਕਰ ਸਕਦਾ ਹਾਂਜੀ ਮੇਰੀ ਨਿਗਾਹ ਦੇ ਵਿੱਚ ਹੈ ਇੱਕ ਕੋਲ ਸੀ ਸੈਂਟਰ ਆ ਆਪਣੇ ਇੱਥੇ ਉਸ ਬੱਚੇ ਨੇ ਮਤਲਬ ਸਟੱਡੀ ਦੇ ਨਾਲ ਨਾਲ ਹੀ ਆਪਣਾ ਇੱਕ ਕੰਪਿਊਟਰ ਦਾ ਛੋਟਾ ਜਿਹਾ ਕੋਚਿੰਗ ਸੈਂਟਰ ਖੋਲ੍ਹਿਆ ਸੀ ਅੱਜ ਉਹ ਕਾਫੀ ਤਰੱਕੀ 'ਤੇ ਆ ਪਹਿਲਾਂ ਉਹਨਾਂ ਆਪਣੇ ਲੋਨ ਲਿਆ ਲੋਨ ਲੈਣ ਦੇ ਨਾਲ ਨਾਲ ਹੀ ਉਹਨਾਂ ਆਪਣੀ ਸਟੱਡੀ ਵੀ ਕੀਤੀ ਅਤੇ ਨਾਲ ਇੱਕ ਕੰਪਿਊਟਰ ਸੈਂਟਰ ਵੀ ਖੋਲ੍ਹਿਆ ਪਾਰਟ ਟਾਈਮ ਉੱਥੇ ਕੰਪਿਊਟਰ ਕਰਵਾਉਂਦਾ ਸੀ ਅੱਜ ਉਹ ਕਾਫੀ ਤਰੱਕੀ ਦੇ ਰਾਹ 'ਤੇ ਹੈ ਅਤੇ ਅੱਜ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਇੰਝ ਆਪਣੀ ਮਿਹਨਤ ਪੱਲੇ ਪੈ ਗਈ ਇਹਦੀ